ਜੀ ਹਾਂ ਪੰਜਾਬ ਵਿੱਚ ਗੁਰਦਾਸਪੁਰ ਬਰਡ ਸੈਂਚਰੀ ਨਾਂ ਦਾ ਇੱਕ ਰਾਸ਼ਟਰੀ ਪਾਰਕ ਹੈ ਇਸ ਵਿੱਚ ਵੱਖ ਵੱਖ ਤਰ੍ਹਾਂ ਦੇ ਪੰਛੀ ਦੁਰਲੱਭ ਤਰ੍ਹਾਂ ਦੇ ਪੰਛੀ ਪਾਏ ਜਾਂਦੇ ਹੈ ਅਤੇ ਇਨ੍ਹਾਂ ਨੂੰ ਜੀਵ ਜੰਤੂ ਨੂੰ ਸੰਭਾਲ ਕੇ ਰੱਖਣ ਵਾਸਤੇ ਵੀ ਬੜੀ ਸਹਾਇਤਾ ਕਰਦੀ ਹੈ ਜੋ ਇੱਥੋਂ ਦੀ ਸਰਕਾਰ ਹੈ ਸਾਰੇ ਇਹ ਸਾਰੀਆਂ ਇਸਨੂੰ ਪੰਛੀਆਂ ਨੂੰ ਖਾਣ ਪੀਣ ਜਾਂ ਉਨ੍ਹਾਂ ਨੂੰ ਪ੍ਰਜਾਤੀ ਬਚਾਉਣ ਵਿੱਚ ਬੜੀ ਸਹਾਇਤਾ ਕਰਦੀ ਹੈ